ਸਾਡੇ ਇਕਾਲੇ ਦੇ ਵਿੱਚ ਅਪਰਾਧ ਬਹੁਤ ਹੁੰਦੇ ਹਨ ਕਿ ਗਰੀਬੀ ਕਾਰਨ ਅਤੇ ਹੋਰ ਠੱਗੇ ਠੋਰੀਆਂ ਕਰਨ ਕਰਨ 'ਤੇ ਅਪਰਾਧ ਹੁੰਦੇ ਹਨ ਜੋ ਕਿ ਆਪਾਂ ਨੂੰ ਜਦੋਂ ਨਸ਼ੈ ਨਸ਼ੇ ਵਾਲੇ ਬੰਦੇ ਆਪਣਾ ਰਾਤਾਂ ਨੂੰ ਸਾਡੇ ਲੋਕਾਂ ਦਾ ਗਰੀਬਾਂ ਦਾ ਹੋਰ ਵੀ ਸਮਾਨ ਚੁੱਕ ਕੇ ਆਪਣੇ ਨਸ਼ੇ ਪੱਤਿਆਂ ਦੇ ਅਪਰਾਧ ਕਰਦੇ ਰਹਿੰਦੇ ਹਨ